ਹਾਂ ਮੈਂ ਅਕਸਰ ਹੀ ਗੁੱਗਲ ਟਰਾਂਸਲੇਟ ਅਤੇ ਗੁੱਗਲ ਮੈਪ ਯੂਜ਼ ਕਰਦਾ ਰਹਿੰਦਾ ਹਾਂ ਮੈਂ ਤੁਹਾਡੇ ਨਾਲ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲੱਗਾ ਹਾਂ ਆਟੋਮੈਟਿਕ ਅਨੁਵਾਦ ਟੂਲ ਅਤੇ ਗੁੱਗਲ ਨਕਸ਼ੇ ਭਾਸ਼ਾ ਦੀਆਂ ਰੁਕਾਵਟਾਂ ਅਤੇ ਭੌਤਿਕ ਥਾਵਾਂ ਦੋਵਾਂ ਨੂੰ ਨੈਵੀਗੇਟ ਕਰਨ ਲਈ ਅਨਮੋਲ ਹਨ ਸਵੈਚਲਿਤ ਅਨੁਵਾਦ ਜਿਵੇਂ ਕਿ ਗੁੱਗਲ ਅਨੁਵਾਦ ਦੁਆਰਾ ਪੇਸ਼ ਕੀਤਾ ਜਾਂਦਾ ਹੈ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਵਿੱਚ ਟੈਕਸਟ ਜਾਂ ਭਾਸ਼ਾ ਨੂੰ ਤੁਰੰਤ ਰੁਪਾਂਤ੍ਰਿਤ ਕਰਨ ਲਈ ਉੱਨਤ ਐੱਲਗੋਰਦਮ ਅਤੇ ਨਿਊਰੋਲ ਨੈੱਟਵਰਕ ਦਾ ਲਾਭ ਉਠਾਉਂਦਾ ਹੈ ਵਿਸ਼ਵਾਸ ਸੰਚਾਰ ਦੀ ਸਹੂਲਤ ਦਿੰਦਾ ਹੈ ਅਤੇ ਵੱਖ ਵੱਖ ਭਾਸ਼ਾਈ ਪਿਛੋਕੜਾਂ ਵਿੱਚ ਜਾਣਕਾਰੀ ਨੂੰ ਪਹੁੰਚਯੋਗ ਬਣਾਉਂਦਾ ਹੈ ਇਹ ਟੈਕਨੋਲੋਜੀ ਉਪਭੋਗਤਾਵਾਂ ਨੂੰ ਵਿਦੇਸ਼ੀ ਭਾਸ਼ਾਵਾਂ ਨੂੰ ਸਮਝਣ ਦੀ ਇਜਾਜ਼ਤ ਦਿੰਦੀ ਹੈ ਭਾਵੇਂ ਯਾਤਰਾ ਵਪਾਰ ਜਾਂ ਸਿੱਖਿਆ ਲਈ ਅਤੇ ਸੱਭਿਆਚਾਰਕ ਮੰਡਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ ਗੁੱਗਲ ਮੈਪ ਦੂਜੇ ਪਾਸੇ ਵਿਆਪਕ ਮੈਪਿੰਗ ਸੇਵਾਵਾਂ ਪ੍ਰਦਾਨ ਕਰਦਾ ਹੈ ਜਿਸ ਵਿੱਚ ਰੀਅਲ ਟੈਮ ਨੈਵੀਗੇਸ਼ਨ ਟਰੈਪ ਅਪਡੇਟਸ ਅਤੇ ਸਥਾਨ ਆਧਾਰਿਤ ਜਾਣਕਾਰੀ ਸ਼ਾਮਿਲ ਹੁੰਦੀ ਹੈ ਇਹ ਉਪਭੋਗਤਾਵਾਂ ਨੂੰ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਕੁਸ਼ਲਤਾ ਨਾਲ ਮਾਰਗਦਰਸ਼ਨ ਕਰਨ ਲਈ ਜੀ ਪੀ ਐੱਸ ਅਤੇ ਸੈਟੇਲਾਈਟ ਡਾਟਾ ਦੀ ਵਰਤੋਂ ਕਰਦਾ ਹੈ ਸਭ ਤੋਂ ਤੇਜ਼ ਰੂਟਾਂ ਅਤੇ ਨੇੜਲੀਆਂ ਸਹੂਲਤਾਂ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ ਇਹਨਾਂ ਸਾਧਨਾਂ ਦੇ ਫਾਇਦੇ ਡੂੰਘੇ ਹਨ ਉਹ ਸਹੂਲਤਾਂ ਨੂੰ ਵਧਾਉਂਦੇ ਪਹੁੰਚਯੋਗਤਾ ਵਿੱਚ ਸੁਧਾਰ ਕਰਦੇ ਹਨ ਅਤੇ ਸਮੇਂ ਦੀ ਬੱਚਤ ਕਰਦੇ ਹਨ ਰੋਜ਼ਾਨਾ ਦੀਆਂ ਗਤੀਵਿਧੀਆਂ ਅਤੇ ਪਰਸਪਰ ਪ੍ਰਭਾਵ ਨੂੰ ਸੁਚਾਰੂ ਅਤੇ ਵਧੇਰੇ ਸੂਚਿਤ ਬਣਾਉਂਦੇ ਹਨ ਇਹਨਾਂ ਤਕਨੋਲਜੀਆਂ ਨੂੰ ਏਕੀਕਰਿਤ ਕਰਕੇ ਉਪਭੋਗਤਾ ਸੰਚਾਰ ਰੁਕਾਵਟਾਂ ਨੂੰ ਪਾਰ ਕਰ ਸਕਦੇ ਹਨ ਅਤੇ ਵਧੇਰੇ ਆਸਾਨੀ ਅਤੇ ਵਿਸ਼ਵਾਸ਼ ਨਾਲ ਸੰਸਾਰ ਨੂੰ ਨੇਵੀਗੇਟ ਕਰ ਸਕਦੇ ਹਨ ਇੱਕ ਵਧੇਰੇ ਜੁੜੇ ਅਤੇ ਸੂਚਿਤ ਵਿਸ਼ਵ ਸਮਾਜ ਵਿੱਚ ਯੋਗਦਾਨ ਪਾ ਸਕਦੇ ਹਨ